ਖੇਡਾਂ ਦੇ ਵਿੱਚ ਜੇ ਗੱਲ ਕਰੀਏ ਤਾਂ ਮੇਰਾ ਭਤੀਜਾ ਜਿਹੜਾ ਸੰਦੀਪ ਸਿੰਘ ਉਹ ਕਬੱਡੀ ਦਾ ਬਹੁਤ ਚੰਗਾ ਇੱਕ ਜਾਫੀ ਹੈ ਆਲੇ ਦੁਆਲੇ ਪੰਜਾਬ ਦੇ ਕੋਈ ਵੀ ਮੇਰਾ ਖਿਆਲ ਉਹਨੇ ਟੂਰਨਾਮੈਂਟ ਨਹੀਂ ਛੱਡਿਆ ਹੋਣਾ ਜਿੱਥੇ ਆਪਣੀ ਟੀਮ ਨੂੰ ਜਿੱਤ ਨਹੀਂ ਦਿਵਾਈ ਅਤੇ ਆਪਣਾ ਨਾਂ ਦਰਜ ਨਹੀਂ ਕਰਵਾਇਆ ਸਾਡੇ ਪੰਜਾਬ ਦੇ ਵਿੱਚ ਕਿਲ੍ਹਾ ਰਾਏਪੁਰ ਦੀਆਂ ਖੇਡਾਂ ਬਹੁਤ ਮਸ਼ਹੂਰ ਹਨ ਉੱਥੇ ਵੀ ਉਹਨੇ ਆਪਣੀ ਟੀਮ ਨੂੰ ਜਿੱਤ ਦਰਜ ਕਰਵਾਈ ਉਹ ਪੰਜਾਬ ਕਬੱਡੀ ਦਾ ਇੱਕ ਬਹੁਤ ਚੰਗਾ ਜਾਫੀ ਹੈ ਸ਼ਾਇਦ ਹੀ ਕੋਈ ਪਲੇਅਰ ਇਹੋ ਜਿਹਾ ਹੋਵੇ ਜਿਸ ਨੂੰ ਬਾਂਹ ਕੱਢ ਕੇ ਉਹਨੇ ਲੋਕ ਨਾ ਲਾਇਆ ਹੋਵੇ ਅਤੇ ਉਹ ਦੀ ਜਿਹੜੀ ਸਿਹਤ ਹੈ ਉਹਦੇ ਨਾਲ ਸਾਡਾ ਵੀ ਇੱਜ਼ਤ ਮਾਣ ਵੱਧਦਾ ਹੈ ਸਾਡੇ ਪਿੰਡ ਦਾ ਨਾਂ ਨਗਰ ਦਾ ਨਾਂ ਉਹਨੇ ਬਹੁਤ ਨਾਂ ਰੌਸ਼ਨ ਕਰਿਆ ਸਾਡੇ ਪਿੰਡ ਦੇ ਨਾਂ ਦੇ ਨਾਲ ਉਹਦਾ ਨਾਂ ਜੋੜਿਆ ਹੋਇਆ ਸਾਡਾ ਪਿੰਡ ਵੀ ਇਸ ਨਾਲ ਬਹੁਤ ਮਸ਼ਹੂਰ ਹੋਇਆ ਹੈ ਅਤੇ ਜਿਹੜੇ ਉਹਦੀ ਗੱਲ ਕਰੀਏ ਤਾਂ ਸਾਡੇ ਨਾਲ ਵੀ ਉਹਦਾ ਜਿਹੜਾ ਸੁਭਾਅ ਬੜਾ ਨਿੱਘਾ ਹੋਇਆ ਕੋਈ ਉਹਦੇ ਵਿੱਚ ਹਉਮੈਂ ਨਹੀਂ ਆਈ ਅਤੇ ਉਹ ਆਪਣੀ ਵਧੀਆ ਗੇਮ ਖੇਡਦਾ ਸਰਕਾਰ ਨੂੰ ਵੀ ਚਾਹੀਦਾ ਕਿ ਜਿਹੜੇ ਪਲੇਅਰ ਖੇਡਾਂ ਖੇਡਦੇ ਨੇ ਇਸ ਤਰ੍ਹਾਂ ਦੇ ਬੱਚੇ ਉਹਨਾਂ ਨੂੰ ਅੱਗੇ ਜਾ ਕੇ ਜਿਹੜੇ ਰਿਜ਼ਾਰਵੇਸ਼ਨ ਆ ਉਹ ਬਹੁਤ ਥੋੜ੍ਹੀ ਹੈ ਰਿਜ਼ਾਰਵੇਸ਼ਨ ਦਿੱਤੀ ਜਾਵੇ ਤਾਂ ਕਿ ਉਹਨਾਂ ਦਾ ਜਿਹੜਾ ਸਮਾਂ ਹੈ ਉਹ ਪੜ੍ਹਾਈ ਦੀ ਬਜਾਏ ਖੇਡਾਂ ਵਿੱਚ ਜ਼ਿਆਦਾ ਲੱਗ ਜਾਂਦਾ ਜਿਹਦੇ ਨਾਲ ਉਹ ਪੜ੍ਹਾਈ ਘੱਟ ਕਰ ਸਕਦੇ ਘਰ ਘੱਟ ਹੁੰਦੀ ਆ ਉਹਨਾਂ ਤੋਂ ਅਤੇ ਉਹਨਾਂ ਨੂੰ ਵਧੀਆ ਪੜ੍ਹਾਈ ਦੇ ਨਾਲ ਨਾਲ ਵਧੀਆ ਨੌਕਰੀ ਵੀ ਉਹਨਾਂ ਵਾਸਤੇ ਰਾਖਵੀਆਂ ਹੋਣੀਆਂ ਚਾਹੀਦੀਆਂ ਹਨ ਜੇਕਰ ਗੱਲ ਕਰੀਏ ਆਪਾਂ ਸਕੂਲਾਂ ਦੀ ਤਾਂ ਸਕੂਲਾਂ ਦੇ ਵਿੱਚ ਅੰਡਰ ਫੋਰਟੀ ਅੰਦਰ ਸੈਵਨਟੀ ਅੰਦਰ ਨਾਇਨਟੀ ਵਗੈਰਾ ਟੂਰਨਾਮੈਂਟ ਹੁੰਦੇ ਨੇ ਪਰ ਇਹ ਟੂਰਨਾਮੈਂਟ ਬਹੁਤ ਘੱਟ ਨੇ ਇਹਨਾਂ ਦੀ ਜਿਹੜੀ ਕੋਚਿੰਗ ਦਾ ਕੋਈ ਬਹੁਤ ਕ ਜ਼ਿਆਦਾ ਪ੍ਰਬੰਧ ਸਕੂਲਾਂ ਦੇ ਵਿੱਚ ਅਜੇ ਨਹੀਂ ਹੈਗਾ ਖੁਰਾਕ ਦਾ ਵੀ ਐਨਾ ਵਧੀਆ ਪ੍ਰਬੰਧ ਨਹੀਂ ਵਧੀਆ ਕੋਚ ਇਹਨਾਂ ਨੂੰ ਸਰਕਾਰੀ ਤੌਰ 'ਤੇ ਮਿਲਣੇ ਚਾਹੀਦੇ ਹਨ ਅਤੇ ਚੰਗੀ ਖੁਰਾਕ ਰਹਿਣ ਸਹਿਣ ਦਾ ਇਹਨਾਂ ਦਾ ਪ੍ਰਬੰਧ ਹੋਣਾ ਚਾਹੀਦਾ ਹੈ ਜੇਕਰ ਇਹ ਬੱਚੇ ਸਾਡੇ ਅੱਜ ਛੋਟੇ ਬੱਚੇ ਖੇਡਾਂ ਸਕੂਲਾਂ ਵਿੱਚ ਖੇਡਣਗੇ ਤਾਂ ਹੀ ਕੱਲ੍ਹ ਨੂੰ ਇਹ ਸਾਨੂੰ ਅੱਗੇ ਜਾ ਕੇ ਸਾਡੇ ਭਾਰਤ ਦਾ ਨਾਂ ਰੌਸ਼ਨ ਕਰ ਸਕਣਗੇ ਅਤੇ ਸਾਨੂੰ ਗੋਲਡ ਮੈਡਲ ਓਲੰਪਿਕ ਏਸ਼ੀਆ 'ਚ ਲਿਆ ਸਕਣਗੇ ਅਤੇ ਬੱਚਿਆਂ ਨੂੰ ਵੀ ਨਸ਼ਿਆਂ ਤੋਂ ਵੀ ਬਚਿਆ ਰਹੇਗਾ ਦਿਮਾਗੀ ਤੌਰ 'ਤੇ ਵੀ ਬੱਚੇ ਸਾਡੇ ਮਜ਼ਬੂਤ ਹੋਣਗੇ ਉਹਦੇ ਨਾਲ ਇਹ ਨਸ਼ਿਆਂ ਤੋਂ ਵੀ ਬਚੇ ਰਹਿਣਗੇ ਅਤੇ ਬੱਚਿਆਂ ਨੂੰ ਜਿਹੜੇ ਖੇਡਾਂ ਨੇ ਉਹ ਜ਼ਰੂਰ ਖੇਡਣੀਆਂ ਚਾਹੀਦੀਆਂ